ਹੈਲੋ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ ਹਾਂ ਵਾਇਟ ਜਿਹਾ ਦੇਖੋ ਸਾਡੇ ਕੋਲ ਐਂਉਂ ਹੀ ਸਾਡੇ ਕੋਲ ਆਹ ਨੋਰਮਲ ਵੀ ਮਿਲਜੂ ਜੇ ਬ੍ਰਾਂਡ ਦੇ ਵਿੱਚ ਚਾਹੀਦੀ ਹੈ ਤਾਂ ਬ੍ਰਾਂਡ ਦੇ ਵਿੱਚ ਵੀ ਮਿਲਜੂ ਜਿਵੇਂ ਸਾਡੇ ਕੋਲ ਬਰੈਂਡ ਦੇ ਵਿੱਚ ਰੈੱਡ ਟੇਪ ਤਾਂ ਹੈਗਾ ਸਾਡੇ ਕੋਲ ਆਊਟਲੈਟ ਇੱਕ ਠੀਕ ਹੈ ਨਾ ਉਹਦੇ ਵਿੱਚ ਹਾਂ ਬਾਕੀ ਜੇ ਤੁਸੀਂ ਸੈਕਟਰੀ ਆਊਟਲੈਟ ਜਾਓਗੇ ਉਹਦੇ ਨਾਲੋਂ ਅਸੀਂ ਸਾਡੇ ਕੋਲ ਦਸ ਪ੍ਰਸੈਂਟ ਤੁਹਾਨੂੰ ਹੋਰ ਲੈਸ ਕਰਕੇ ਦੇਵਾਂਗੇ ਅਸੀਂ ਜੇ ਹੋਮ ਡਿਲੀਵਰੀ ਚਾਹੀਦੀ ਆ ਤਾਂ ਸਾਨੂੰ ਬੱਸ ਮਾਡਲ ਭੇਜੋ ਸਾਨੂੰ ਫੋਟੋ ਭੇਜੋ ਉਹਦਾ ਨੰਬਰ ਭੇਜੋ ਅਤੇ ਆਪਣਾ ਐਡਰੈਸ ਭੇਜੋ 'ਤੇ ਅਸੀਂ ਹੋਮ ਡਿਲੀਵਰੀ ਕਰਦੇ ਹਾਂ ਸਾਡੇ ਕੋਲ ਹੋਮ ਡਿਲੀਵਰੀ ਦੇ ਦੇਖੋ ਆਪਣੇ ਸ਼ਹਿਰ ਦੇ ਹਿਸਾਬ ਨਾਲ ਆ ਕੋਈ ਪੰਜਾਹ ਰੁਪਏ ਕੋਈ ਸੱਤਰ ਰੁਪਏ ਸੌ ਤੋਂ ਜ਼ਿਆਦਾ ਕੋਈ ਵੀ ਹੈਗਾ ਅਤੇ ਬਾਕੀ ਲੇਡੀਜ ਵੀ ਆ ਸਾਡੇ ਕੋਲ ਸਾਰੀਆਂ ਅਤੇ ਬੱਚਿਆਂ ਲਈ ਵੀ ਆ ਜੈਂਟਸ ਲਈ ਵੀ ਆ ਫਾਰਮਰ ਜੋ ਹੋ ਗਏ ਕੈਜ਼ੁਅਲ ਹੋ ਗਏ ਕਨਿਕਰ ਹੋ ਗਏ ਤਾਂ ਆਲ ਟਾਈਪ ਆਪਣਾ ਕੰਮ ਹੈਗਾ ਵਧੀਆ ਨਹੀਂ ਦੇਖੋ ਫ਼ਿਲਹਾਲ ਇਹੋ ਜਿਹੀ ਆਫਰ ਸਾਡੀ ਕੋਈ ਨਹੀਂ ਚੱਲਦਾ ਚੱਲ ਰਹੀ ਕਿਉਂਕਿ ਸਾਡੇ ਬੂਟ ਇਹੀ ਨੇ ਮਤਲਬ ਜੈਨੂਅਨ ਨੇ ਰੇਟ ਉਹਨਾਂ ਦੇ ਅਤੇ ਜੇ ਮੈਂ ਤੁਹਾਨੂੰ ਕਿਹਾ ਨਾ ਬਈ ਰੈੱਡ ਟੇਪ ਨਾਲੋਂ ਦਸ ਪ੍ਰਸੈਂਟ ਹੋਰ ਅਸੀਂ ਲੈਸ ਕਰਕੇ ਦੇਵਾਂਗੇ ਤੁਹਾਨੂੰ ਬਾਕੀ ਹਾਂ ਬਾਕੀ ਜੇ ਬਾਕੀ ਜੇ ਹਾਂ ਬਾਕੀ ਜੇ ਕੋਈ ਸਾਨੂੰ ਹੋਰ ਬੈਂਡ ਚਾਹੀਦੇ ਤਾਂ ਸਾਨੂੰ ਫੋਟੋ ਭੇਜੋ ਅਸੀਂ ਉਹਦੀ ਫਸਟ ਕਾਪੀ ਆ ਉਹ ਤੁਹਾਨੂੰ ਭੇਜ ਦੇਵਾਂਗੇ ਬਿਲਕੁਲ ਆ ਜੀ ਹੰਡਰਡ ਐਡ ਵੰਨ ਪ੍ਰਸੈਂਟ ਓਰੀਜਨਲ ਸਟਾਰਟਿੰਗ ਨੌਂ ਸੌ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਉਪਰ ਦਾ ਤੱਕ ਵੀ ਨੇ ਕਿਉਂਕਿ ਜਦੋਂ ਜੇ ਤੁਸੀਂ ਨਾਈਕੀ ਦੇ ਸ਼ੂਜ਼ ਦੇਖੋ ਕਿੱਦਾਂ ਸਾਡੇ ਕੋਲ ਮਤਲਬ ਵੀ ਪੰਜ ਹਜ਼ਾਰ ਛੇ ਹਜ਼ਾਰ ਸੱਤ ਹਜ਼ਾਰ ਦਸ ਹਜ਼ਾਰ ਤੱਕ ਵੀ ਹੈਗੇ ਨੇ ਹਾਂ ਬਿਲਕੁਲ ਹਾਂ ਨਹੀਂ ਬਿਲਕੁਲ ਦਿਵਾਲੀ 'ਤੇ ਜ਼ਰੂਰ ਅਸੀਂ ਮਤਲਬ ਬਈ ਆਫਰ ਕਰਦੇ ਹੁੰਦੇ ਆ ਲੇਡੀਜ ਅਤੇ ਬੱਚਿਆਂ ਲਈ ਜੈਂਟਸ ਲਈ ਵੀ ਅਸੀਂ ਕਰਦੇ ਹੁੰਦੇ ਆ ਪਰ ਉਹ ਸਿਰਫ ਵੀ ਨੋਰਮਲ ਬੂਟ ਹੁੰਦੇ ਨੇ ਬਰਾਂਡ ਦੇ ਵਿੱਚ ਕੋਈ ਨਹੀਂ ਹੁੰਦਾ ਸਾਡੇ ਲੋਕ ਮੇਡ ਹੁੰਦੇ ਨੇ ਨਹੀਂ ਨਹੀਂ ਸਰ ਇਕੱਲੀ ਬਰਨਾਲੇ ਹਾਂਜੀ ਹਾਂਜੀ ਸਰ ਬਰਨਾਲਾ ਜੀ ਬਾਕੀ ਕੋਈ ਨਾ ਕੋਈ ਦਿੱਕਤ ਨਹੀਂ ਤੁਸੀਂ ਸਾਡਾ ਇੰਸਟਾਗਰਾਮ ਪੇਜ ਚੈੱਕ ਕਰੋ ਉਥੇ ਅਸੀਂ ਡੇਲੀ ਅਪਡੇਟ ਕਰਦੇ ਹਾਂ ਬਈ ਕਿਹੜਾ ਕਿਹੜਾ ਅਸੀਂ ਹਾਂ ਇਹੀ ਆ ਬਿੱਕੀ ਮੇਰਾ ਨਾਮ ਹੈ ਮੇਰਾ ਨਾਮ ਆ ਬਿੱਕੀ ਸ਼ੂਜ ਬੱਸ ਉਹ ਤਾਂ ਤੁਸੀਂ ਕੱਟ ਲਓ ਹਾਂਜੀ ਓਕੇ ਜੀ